ਸਾਡੇ ਖੇਤਰ ਵਿੱਚ ਅਤੇ ਨੇੜੇ ਨੇੜੇ ਬਹੁਤ ਹੀ ਪ੍ਰਾਈਵੇਟ ਹਸਪਤਾਲ ਹਨ ਜੋ ਕਿ ਸਰਕਾਰੀ ਹਸਪਤਾਲਾਂ ਵਿੱਚੋਂ ਡਾਕਟਰ ਉੱਠ ਉੱਠ ਕੇ ਆਪਣੇ ਹਸਪਤਾਲ ਪ੍ਰਾਈਵੇਟ ਖੋਲ੍ਹੀ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਸਰਕਾਰੀ ਵਿੱਚ ਲਾਭ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਪ੍ਰਾਈਵੇਟਾਂ ਵਿੱਚ ਬਹੁਤ ਲਾਭ ਹੁੰਦਾ ਹੈ ਕਿਉਂਕਿ ਉਹ ਉਹਨਾਂ ਦੀਆਂ ਗੱਡੀਆਂ ਅਤੇ ਉਹਨਾਂ ਦੇ ਆਪਣੇ ਬਹੁਤ ਸਾਰੇ ਸਾਧਨ ਹੁੰਦੇ ਹਨ ਕਿਉਂਕਿ ਸਾਡੇ ਸਰਕਾਰੀ ਵਿੱਚ ਇੰਨੀ ਮਹਾਨਤਾ ਨਹੀਂ ਹੁੰਦੀ ਜਿੰਨੀ ਕਿ ਪ੍ਰਾਈਵੇਟ ਵਿੱਚ ਹੁੰਦੀ ਹੈ ਸਾਡੇ ਗਰੀਬ ਜਨਤਾ ਪ੍ਰਾਈਵੇਟ ਪ੍ਰਾਈਵੇਵ ਵਿੱਚ ਨਹੀਂ ਜਾ ਜਾਂਦੇ ਨਹੀਂ ਜਾਂਦੇ ਕਿਉਂਕਿ ਉਸ ਵਿੱਚ ਹਾਂ ਬਹੁਤ ਹੀ ਪੈਸ ਫੀਸਾਂ ਹੁੰਦੀਆਂ ਹਨ ਅਤੇ ਕਹਿੰਦੇ ਨੇ ਬਹੁਤ ਹੀ ਫੀਸਾਂ ਲਈਆਂ ਜਾਂਦੀਆਂ ਹਨ ਅਤੇ ਰਹਿਣ ਸਹਿਣ ਦਾ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਖਾਣ ਪੀਣ ਦਾ ਵੀ ਖਰਚਾ ਬਹੁਤ ਹੁੰਦਾ ਹੈ ਅਤੇ ਇਸ ਲਈ ਸਾਡੇ ਗਰੀਬ ਜਨਤਾ ਹਾਂ ਸਰਕਾਰੀ ਵਿੱਚੋਂ ਉੱਠ ਕੇ ਪ੍ਰਾਈਵੇਟ ਤਾਂ ਚਲੇ ਜਾਂਦੇ ਹਨ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਿਉਂਕਿ ਉਹ ਗਰੀਬ ਲੋਕ ਹਾਂ ਇਹਨਾਂ ਗਰੀਬ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੁੰਦਾ ਵੀ ਉਹ ਹਸ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾਉਣ ਕਿਉਂਕਿ ਉੱਥੇ ਹਾਂ ਕ ਜਿਵੇਂ ਕਿ ਸਰਕਾਰੀ ਹਸਪਤਾਲਾਂ ਵਿੱਚ ਤਾਂ ਕਾਰਡ ਚੱਲਦਾ ਹੈ ਉਹ ਵਿੱਚ ਨਹੀਂ ਚੱਲਦਾ ਹੈ ਅਤੇ ਉਹਨਾਂ ਦੀ ਐਬੂਲੈਂਸਾਂ ਵੀ ਆਪਣੀਆਂ ਆਉਂਦੀਆਂ ਹਨ ਅਤੇ ਪ੍ਰਾਈ ਪ੍ਰਾਈਵੇਟ ਸਪਤਾਲਾਂ ਵਿੱਚ ਫੀਸਾਂ ਤਾਂ ਬਹੁਤ ਹੀ ਜ਼ਿਆਦਾ ਹੁੰਦੀਆਂ ਹਨ ਤਾਂ ਜੋ ਸਾਡੇ ਗਰੀਬ ਜਨਤਾ ਨਹੀਂ ਲਾ ਸਕਦੀ ਅਤੇ ਪ੍ਰਾਈਵੇਟ ਹਸਪਤਾਲ ਹਾਂ ਤਾਂ ਕਿ ਅੱਜ ਕੱਲ੍ਹ ਬਹੁਤ ਹੀ ਮਸ਼ਹੂਰ ਬਣਾਏ ਗਏ ਹਨ ਕਿਉਂਕਿ ਜੇਕਰ ਸਰਕਾਰੀ ਵਿੱਚ ਨਹੀਂ ਸੁਣੀ ਜਾ ਜਾਂਦੀ ਤਾਂ ਗ ਸ ਗਰੀਬ ਜਨਤਾ ਉੱਥੇ ਪ੍ਰਾਈਵੇਟ 'ਚ ਵਿੱਚ ਚਲੀ ਜਾਂਦੀ ਹੈ ਕਿਉਂਕਿ ਪ੍ਰਾਈਵੇਟ ਪ੍ਰਾਈਵੇਟ ਵਿੱਚ ਤਾਂ ਵੱਡੇ ਲੋਕਾਂ ਦੀ ਪੈਸੇ ਅਮੀਰ ਲੋਕਾਂ ਦੀ ਵੀ ਸੁਣੀ ਜਾਂਦੀ ਹੈ ਕਿਉਂਕਿ ਉਹਨਾਂ ਕੋਲ ਪੈਸਾ ਜ਼ਿਆਦਾ ਹੁੰਦਾ ਤਾਂ ਗਰੀਬ ਲੋਕਾਂ ਦੀ ਘੱਟ ਹੀ ਉਹ ਘੱਟ ਹੀ ਸੁਣੀ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਤਾਂ ਪੈ ਪ੍ਰਾਈਵੇਟ ਹਸਪਤਾਲਾਂ ਨੂੰ ਤਾਂ ਪੈਸਿਆਂ ਤੱਕ ਹੀ ਮਤਲਬ ਹੁੰਦਾ ਹੈ